ਮਿੱਡ ਡੇ ਮਿਲ ਸਕੀਮ ਇੱਕ ਸਕੂਲਾਂ ਵਿੱਚ ਬੱਚਿਆਂ ਦੀ ਸ਼ੁਰੂ ਕੀਤੀ ਗਈ ਭੋਜਨ ਪ੍ਰਣਾਲੀ ਇੱਕ ਬਹੁਤ ਚੰਗਾ ਉਪਰਾਲਾ ਹੈ ਮਿੱਡ ਡੇ ਮਿਲ ਤੋਂ ਭਾਵ ਕਿ ਅੱਧੇ ਦਿਨ ਅਤੇ ਦਿਨ ਦੇ ਅੱਧੇ ਦਿਨ ਅੱਧੇ ਸਮੇਂ ਵਿੱਚ ਦਿੱਤਾ ਜਾਣ ਵਾਲਾ ਮੀਲ ਦਿੱਤਾ ਜਾਣ ਵਾਲਾ ਭੋਜਨ ਇਹ ਬਹੁਤ ਕਾਮਯਾਬ ਸਕੀਮ ਕਹੀ ਜਾ ਸਕਦੀ ਕਿਉਂਕਿ ਬੱਚੇ ਸਾਡੇ ਦੇਸ਼ ਵਿੱਚ ਕਾਫੀ ਬੱਚੇ ਜੋ ਰੋਟੀ ਤੋਂ ਬਿਨਾਂ ਸੌਂਦੇ ਹਨ ਜਿਹੜੇ ਬੱਚੇ ਰੋਟੀ ਤੋਂ ਬਿਨਾਂ ਸੌਂਦੇ ਹਨ ਉਹ ਸਕੂਲ ਕਿਵੇਂ ਆ ਸਕਣਗੇ ਇੱਕ ਤਾਂ ਸਕੂਲ ਵਿੱਚ ਹਾਜ਼ਰੀ ਵਧੀ ਇਸ ਨਾਲ ਕਿਉਂਕਿ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਭੋਜਨ ਵੀ ਪ੍ਰਾਪਤ ਹੋਣ ਲੱਗਾ ਭੋਜਨ ਪੌਸ਼ਟਿਕ ਭੋਜਨ ਬੱਚਿਆਂ ਦੀ ਸਿਹਤ ਨੂੰ ਖਿਆਲ ਰੱਖਦੇ ਉਹਨਾਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਣ ਲੱਗਾ ਪੌਸ਼ਟਿਕ ਭੋਜਨ ਦੇ ਦੇਣ ਨਾਲ ਉਹਨਾਂ ਨੂੰ ਵਿੱਦਿਆ ਪ੍ਰਦਾਨ ਕੀਤੀ ਜਾਣ ਲੱਗੀ ਇਹ ਸਕੀਮ ਜਿਹੜੀ ਸੀ ਉਹ ਅੱਠਵੀਂ ਤੱਕ ਦੇ ਬੱਚਿਆਂ ਲਈ ਸ਼ੁਰੂ ਕੀਤੀ ਗਈ ਸੀ ਅਤੇ ਇਹ ਸਕੀਮ ਦੇ ਨਾਲ ਨਾਲ ਕਈਆਂ ਨੂੰ ਰੁਜ਼ਗਾਰ ਵੀ ਮਿਲਿਆ ਜਿਵੇਂ ਉਹਨਾਂ ਬੱਚਿਆਂ ਨੂੰ ਭੋਜਨ ਤਿਆਰ ਕਰਨ ਲਈ ਕੁਛ ਬੀਬੀਆਂ ਨੂੰ ਰੱਖਿਆ ਗਿਆ ਜੋ ਬੱਚਿਆਂ ਨੂੰ ਭੋਜਨ ਤਿਆਰ ਕਰਕੇ ਦਿੰਦੀਆਂ ਸਨ ਇਹ ਭੋਜਨ ਮਿਲਣ ਨਾਲ ਕਾਫੀ ਜ਼ਿਆਦਾ ਤਾਦਾਦ ਵਿੱਚ ਬੱਚੇ ਸਕੂਲ ਆਉਣਾ ਸ਼ੁਰੂ ਹੋ ਗਏ ਉਹ ਉਹਨਾਂ ਦੀ ਸਿਹਤ ਵਿੱਚ ਵੀ ਤੰਦਰੁਸਤੀ ਆਈ ਸਿਹਤ ਵਿੱਚ ਤੰਦਰੁਸਤੀ ਦੇ ਨਾਲ ਨਾਲ ਉਹਨਾਂ ਨੇ ਵਿੱਦਿਆ ਨੂੰ ਗ੍ਰਹਿਣ ਕਰਨਾ ਸ਼ੁਰੂ ਕੀਤਾ ਤੰਦਰੁਸਤ ਸਰੀਰ ਹੀ ਵਿੱਦਿਆ ਨੂੰ ਗ੍ਰਹਿਣ ਕਰ ਸਕਦਾ ਹੈ ਇਸੇ ਆਧਾਰ 'ਤੇ ਇਸ ਨੂੰ ਬਹੁਤ ਕਾਮਯਾਬ ਸਕੀਮ ਕਿਹਾ ਜਾ ਸਕਦਾ ਹੈ ਸ਼ੁਕਰੀਆ